ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਬੀਕਾਨੇਰ ਸਵੀਟਸ ਤੋਂ ਬੋਲਿਆ ਕਰਦੇ ਹੋ ਆ ਭਾਅ ਜੀ ਮੈਂ ਅੱਧੇ ਕੁ ਪੌਣੇ ਘੰਟੇ ਪਹਿਲਾਂ ਤੁਹਾਡੇ ਕੋਲ ਇੱਕ ਔਡਰ ਲਿਖਵਾਇਆ ਸੀ ਚਾਰ ਨਾਨ ਦਾਲ ਮੱਖਣੀ ਚੋਲ ਅਤੇ ਦਹੀਂ ਦਾ ਇਹ ਭਾਅ ਜੀ ਔਡਰ ਮੇਰਾ ਵਿਨਾਸ਼ਾ ਸਿੰਘ ਦੇ ਨਾਂ ਤੋਂ ਆ ਹਾਂਜੀ ਹਾਂਜੀ ਭਾਅ ਜੀ ਵਿਨਾਸ਼ਾ ਸਿੰਘ ਦੇ ਨਾਂ ਤੋਂ ਆ ਕੀ ਹੋਇਆ ਭਾਅ ਜੀ ਭਾਅ ਜੀ ਮੈਂ ਤਾਂ ਔਨਲਾਈਨ ਪੇਮੈਂਟ ਵੀ ਕਰਤੀ ਟ੍ਰਾਂਜੈਕਸ਼ਨ ਵੀ ਕਰਤੀਆਂ ਚੱਲੋ ਕੋਈ ਨਹੀਂ ਮੇਰੇ ਕੋਲੋਂ ਔਡਰ ਕੋਡ ਲਿਖ ਲਓ ਕਿ ਪਤਾ ਔਡਰ ਹੀ ਲੱਭ ਜਾਵੇ ਤੁਹਾਡਾ ਲਿਖੋ ਲਿਖੋ ਉੱਨੀ ਅਠਾਰਾਂ ਵੀਹ ਇਕਹੱਤਰ ਬਾਰਾਂ ਹਾਂਜੀ ਹਾਂਜੀ ਵਿਨਾਸ਼ਾ ਸਿੰਘ ਦੇ ਨਾਂ ਤੋਂ ਆ ਔਨਲਾਈਨ ਪੇਮੈਂਟ ਕਰਤੀ ਭਾਅ ਜੀ ਮੈਂ ਤੁਹਾਨੂੰ ਹਾਂਜੀ ਹਾਂਜੀ ਉਹ ਗੂਗਲ ਪੇਅ 'ਤੇ ਕੀਤੀ ਜੀ ਅਤੇ ਭਾਅ ਜੀ ਮੈਂ ਇੱਕ ਗੱਲ ਪੁੱਛਣੀ ਜਿੱਦਾਂ ਕਿ ਆਪਣਾ ਮਿੱਠੇ 'ਚ ਕੁਛ ਐਡ ਕਰਨਾ ਹੋਵੇ ਹੋ ਜਾਵੇਗਾ ਹਾਂਜੀ ਉਹ ਹੀ ਸੋਚਿਆ ਕਰਦੇ ਕਿ ਜਿੱਦਾਂ ਔਡਰ ਕਰਾਈ ਦੀ ਆ ਹੁਣ ਰੋਟੀ ਬਾਹਰੋਂ ਆਇਆ ਕਰਦੀ ਆ ਤਾਂ ਹੁਣ ਮਿੱਠਾ ਵੀ ਬਾਹਰੋਂ ਹੀ ਮੰਗਵਾ ਲਈਏ ਫਿਰ ਹਾਂਜੀ ਹਾਂਜੀ ਅਤੇ ਭਾਅ ਜੀ ਇਹ ਔਡਰ ਕਰ ਦਿਓ ਫਿਰ ਤੁਹਾਡੇ ਕੋਲ ਮਿੱਠੇ 'ਚ ਕੀ ਕੀ ਵਰਾਈਟੀ ਪਈ ਆ ਆਈਸ ਕ੍ਰੀਮ ਹੋ ਗਈ ਆਈਸ ਕ੍ਰੀਮ ਕਿਹੜੇ ਕਿਹੜੇ ਫਲੇਵਰ ਦੀ ਆ ਚੋਕਲੇਟ ਆਈਸ ਕ੍ਰੀਮ ਕਿਹੜੇ ਚੋਕਲੇਟ ਦੀ ਨਹੀਂ ਭਾਜੀ ਆਈਸ ਕ੍ਰੀਮ ਰਹਿਣ ਹੀ ਦਿਓ ਮਨਾ ਕਰਿਆ ਕਰਦੇ ਆ ਇਹ ਤਾਂ ਹੋਰ ਕੁਝ ਹੋਏ ਮਿੱਠੇ 'ਚ ਆਪਣਾ ਜਿੱਦਾਂ ਕੀ ਕੀ ਪਿਆ ਅੱਛਾ ਅੱਛਾ ਗੁਲਾਬ ਜਾਮੁਨ ਕਿਹੜੇ ਭਾਅ ਜੀ ਗਰਮ ਕਿ ਠੰਡੇ ਅੱਛਾ ਅਤੇ ਹੋਰ ਗੁਲਾਬ ਜਾਮੁਨਾਂ ਨਾਲ ਨਹੀਂ ਭਾਅ ਜੀ ਰਬੜੀ ਕਿਹਨੇ ਖਾਣੀ ਹੁਣ ਰਬੜੀ ਕੱਲ੍ਹ ਖਾਦੀ ਸੀ ਬਥੇਰੀ ਖਾ ਲਈ ਅੱਛਾ ਨਹੀਂ ਜਲੇ ਜਲੇਬੀਆਂ ਤਾਂ ਰਹਿਣ ਹੀ ਦਿਓ ਭਾਅ ਜੀ ਜਲੇਬੀਆਂ ਨਹੀਂ ਖਾਣੀਆਂ ਗੁਲਾਬ ਜਾਮੁਨ ਇੱਦਾਂ ਕਰੋ ਤੁਸੀਂ ਅੱਛਾ ਰਸਮਲਾਈ ਵੀ ਆ ਚਲੋ ਕੋਈ ਨਹੀਂ ਤੁਸੀਂ ਇੱਦਾਂ ਕਰੋ ਚਾਰ ਪੰਜ ਬੰਦਿਆਂ ਦੇ ਖਾਣ ਜੋਗੀ ਗੁਲਾਬ ਜਾਮੁਨ ਅਤੇ ਰਸਮਲਾਈ ਪੈਕ ਕਰ ਦਿਓ ਅਤੇ ਜਿਸ ਵੇਲੇ ਤੁਸੀਂ ਆ ਹਾਂਜੀ ਹਾਂਜੀ ਜਿਸ ਵੇਲੇ ਔਡਰ ਪੈਕ ਹੋ ਜਾਵੇਗਾ ਤਾਂ ਮੈਨੂੰ ਫੋ ਇਸੇ ਫ਼ੋਨ ਨੰਬਰ 'ਤੇ ਫ਼ੋਨ ਕਰ ਦਿਓ ਮੈਂ ਆਪਣਾ ਔਡਰ ਲੈਣ ਆ ਜਾਵਾਂਗਾ ਠੀਕ ਆ ਭਾਅ ਜੀ ਥੈਂਕ ਯੂ ਭਾਅ ਜੀ ਭਾਅ ਜੀ ਹਾਂਜੀ ਇਹ ਹੀ ਪੁੱਛਣਾ ਸੀ ਭਾਅ ਜੀ ਕਿ ਮਿੱਠਾ ਐਡ ਹੋ ਜਾਵੇਗਾ ਨਹੀਂ ਹੋਵੇਗਾ ਇਹ ਜੀ ਚਾਰ ਪੰਜ ਬੰਦਿਆਂ ਦਾ ਕਰ ਦਿਓ ਮਿੱਠਾ ਹਾਂ ਗੁਲਾਬ ਜਾਮੁਨ ਅਤੇ ਰਸਮਲਾਈ ਕਰ ਦਿਓ ਭਾਅ ਜੀ ਓਕੇ ਭਾਅ ਜੀ ਥੈਂਕ ਯੂ ਭਾਅ ਜੀ